ਜੀ ਹਾਂ ਮੈਂ ਇੰਡੀਅਨ ਆਈਡਲ ਵਰਗੇ ਸੰਗੀਤ ਰਿਐਲਟੀ ਸ਼ੋ ਦੇਖਣੇ ਬਹੁਤ ਪਸੰਦ ਕਰਦੀ ਹਾਂ ਪਿਛਲੇ ਚਾਰ ਤੋਂ ਪੰਜ ਸਾਲ ਤੋਂ ਮੈਂ ਇੰਡੀਅਨ ਆਈਡਲ ਦੇਖ ਰਹੀ ਹਾਂ ਇਸ ਵਾਰ ਇੱਕ ਭਾਗੀਦਾਰ ਆਇਆ ਜਿਹਦਾ ਨਾਮ ਪ੍ਰਿਅੰਸ਼ੂ ਦੱਤਾ ਹੈ ਜੋ ਕਿ ਕੋਲਕਾਤਾ ਦਾ ਰਹਿਣ ਵਾਲਾ ਹੈ ਜਿਸਦੀ ਉਮਰ ਸਿਰਫ ਬਾਈ ਸਾਲ ਹੈ ਉਹਦੀ ਗਾਇਕੀ ਬਹੁਤ ਹੀ ਸੰਜੀਦਗੀ ਵਾਲੀ ਹੈ ਸਭ ਤੋਂ ਨਿਆਰੀ ਗੱਲ ਇਹ ਹੈ ਕਿ ਉਹਨੇ ਹੋਰਨਾ ਗਾਇਕਾਂ ਵਾਂਗ ਬਚਪਨ ਤੋਂ ਗਾਇਕੀ ਨਹੀਂ ਸਿੱਖੀ ਸਗੋਂ ਯੂਟਿਊਬ ਦਾ ਸਹਾਰਾ ਲੈ ਕੇ ਆਪਣੀ ਗਾਇਕੀ ਨੂੰ ਨਿਖਾਰਿਆ ਹੈ ਉਹ ਹਰ ਗਾਣੇ ਨੂੰ ਘੱਟੋ ਘੱਟ ਪੰਜਾਹ ਵਾਰੀ ਸੁਣ ਕੇ ਫਿਰ ਉਸਦੇ ਇਕੱਲੇ ਇਕੱਲੇ ਨੋਟ 'ਤੇ ਧਿਆਨ ਦੇ ਕੇ ਉਸਨੂੰ ਸਿੱਖਦਾ ਹੈ ਅਤੇ ਹੂ ਬ ਹੂ ਓਰੀਜਨਲ ਗਾਇਕ ਦੇ ਵਾਂਗ ਗਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ ਅਤੇ ਉਹ ਆਪਣੇ ਗਾਣੇ ਵਿੱਚ ਆਪਣਾ ਵੀ ਇੱਕ ਅਲੱਗ ਹੀ ਸੁਰ ਅੰਦਾਜ਼ ਪੇਸ਼ ਕਰਦਾ ਹੈ ਜੋ ਕਿ ਉਸ ਗਾਣੇ ਨੂੰ ਓਰੀਜਨਲ ਗਾਣੇ ਤੋਂ ਵੀ ਹੋਰ ਜ਼ਿਆਦਾ ਸੋਹਣਾ ਅਤੇ ਸਕੂਨ ਭਰਿਆ ਸੁਰੀਲਾ ਬਣਾ ਦਿੰਦਾ ਹੈ ਜੋ ਕਿ ਮੈਨੂੰ ਬਹੁਤ ਪਸੰਦ ਹੈ ਜੋ ਕਿ ਸੁਣ ਕੇ ਮੇਰੀ ਰੂਹ ਖਿੜ ਜਾਂਦੀ ਹੈ ਉਸਦਾ ਗਾਇਆ ਬੇਦਰਦੀਆ ਗਾਣਾ ਮੇਰੀ ਰੂਹ ਨੂੰ ਖਿਲ ਖਿਲਾ ਗਿਆ ਧੰਨਵਾਦ